ਮੈਂ ਇੱਕ ਸ਼ੋਪਿੰਗ ਸ਼ੋਪਿੰਗ ਕਾਰਡ ਵਿੱਚ ਆਪਣਾ ਮੋਬਾਈਲ

ਕੀਤਾ ਸੀ ਅਤੇ ਇਸ ਮਾਈਲ ਨਾ ਇਸ ਮੋਬਾਈਲ ਦੀ ਮੈਨੂੰ ਬਹੁਤ ਜ਼ਰੂਰਤ ਸੀ ਲੇਕਿਨ ਹੁਣ ਮਾਰਕੀਟ ਵਿੱਚ ਨਵੇਂ ਵਰਜਨ ਆ ਗਏ ਹਨ ਮੈਂ ਪਹਿਲਾਂ ਵੀਵੋ ਦਾ ਮੋਬਾਈਲ ਮੰਗਵਾਇਆ ਸੀ ਲੇਕਿਨ ਹੁਣ ਮੈਨੂੰ ਸਿਮ ਸੌਂਗ ਦਾ ਪਸੰਦ ਹੈ ਉਸਦਾ ਵਰਜ਼ਨ ਵਧੀਆ ਹੈ ਇਸ ਲਈ ਮੈਂ ਜਿਹੜਾ ਕਿ ਮੋਬਾਈਲ ਆਪਣੇ ਸ਼ੋਪਿੰਗ ਕਾਰਡ ਦੁਆਰਾ ਮੰਗਵਾਇਆ ਸੀ ਉਸ ਨੂੰ ਹਟਾਉਣ ਲਈ ਆਪਣੀ ਸ਼ੋਪਿੰਗ ਕਾਰਡ ਉੱਪਰ ਇੱਕ ਆਪਸ਼ਨ ਰਿਜੈਕਟ ਆਪਸ਼ਨ ਆਵੇਗੀ ਅਤੇ ਮੈਂ ਉਸ ਉੱਪਰ ਕਲਿੱਕ ਕਰਕੇ ਉਸ ਨੂੰ ਹਟਾ ਦੇਵਾਂਗੀ ਥੋੜ੍ਹੀ ਦੇਰ ਬਾਅਦ ਮੈਂ ਆਪਣੇ ਸ਼ੋਪਿੰਗ ਕਾਰਡ 'ਤੇ ਜਾ ਕੇ ਚੈੱਕ ਕੀਤਾ ਅਤੇ ਮੇਰਾ ਜਿਹੜਾ ਸਮਾਰਟ ਫੋਨ ਹਟਾ ਦਿੱਤਾ ਗਿਆ ਸੀ